ਹਾਂਜੀ ਜੀ ਤੁਸੀਂ ਮੈਨੂੰ ਦੱਸ ਸਕਦੇ ਹੋ ਤੁਹਾਡੇ ਸ਼ੋਪ 'ਤੇ ਕਿਹੜੇ ਕਿਹੜੇ ਹੈਗੇ ਨੇ ਕੱਪੜੇ ਜੀ ਮੈਨੂੰ ਔਰਗੈਨਜਾ ਸਿਲਕ 'ਚ ਚਾਹੀਦਾ ਕਿ ਤੁਸੀਂ ਮੈਨੂੰ ਉਹਦਾ ਪ੍ਰਾਈਜ ਦੱਸ ਦਿਓ ਮੈਮ ਰੇਟ ਤਾਂ ਬਹੁਤ ਜ਼ਿਆਦਾ ਏ ਜੇ ਆਪਾਂ ਬਾਹਰੋਂ ਕਿਤੋਂ ਲਈਏ ਤਾਂ ਉੱਥੇ ਤਾਂ ਬਹੁਤ ਘੱਟ ਦੱਸ ਰਹੇ ਹੈ ਨਹੀਂ ਫੇਰ ਵੀ ਬਹੁਤ ਜ਼ਿਆਦਾ ਏ ਇਹ ਤਾਂ ਇੱਕ ਬਾਹਰੋਂ ਹੁਣੇ ਹੀ ਸਾਡੇ ਨਾਲ ਦੇ ਕਿਸੇ ਨੇ ਲੀਤਾ ਏ ਉਹਨਾਂ ਨੇ ਤਾਂ ਪੰਜ ਸੌ ਰੁਪਏ ਦਾ ਲਿਤਾ ਜੀ ਤੁਸੀਂ ਤਾਂ ਦੋ ਹਜ਼ਾਰ ਤਾਂ ਬਹੁਤ ਜ਼ਿਆਦਾ ਦੱਸ ਰਹੇ ਹੋ ਜੀ ਮੈਨੂੰ ਪੰਜ ਸੂਟ ਲੈਣੇ ਸੀ ਇਸ ਹਿਸਾਬ ਨਾਲ ਤੁਸੀਂ ਤਾਂ ਬਿੱਲ ਹੀ ਦਸ ਹਜ਼ਾਰ ਦਾ ਬਣਾ ਦੋਗੇ ਨਹੀਂ ਨਹੀਂ ਤੁਸੀਂ ਪਹਿਲਾਂ ਮੈਨੂੰ ਫਾਈਨਲ ਕਰੋ ਵੀ ਕਿੰਨਾ ਡਿਸਕਾਊਂਟ ਮਿਲ ਸਕਦਾ ਅਤੇ ਤੁਹਾਡੇ ਕੋਲ ਕਲਰ ਕਿਹੜੇ ਕਿਹੜੇ ਅਵੇਲੇਬਲ ਨੇ ਫਿਰ ਵੀ ਬਹੁਤ ਜ਼ਿਆਦਾ ਹੋ ਜਾਏਗਾ ਤੁਸੀਂ ਥੋੜ੍ਹਾ ਤਾਂ ਘੱਟ ਕਰੋ ਨਾ ਇਸ ਹਿਸਾਬ ਨਾਲ ਅਸੀਂ ਤਾਂ ਕੱਪੜੇ ਹੀ ਖਰੀਦਦੇ ਰਹਿ ਜਾਂਗੇ ਫਿਰ ਪੱਕਾ ਬਿੱਲ ਤਾਂ ਸਾਰੇ ਦਿਨ ਦੇ ਹੀ ਹੈ ਉਹ ਤਾਂ ਆਪਦੇ ਕਸਟਮਰ ਦੀ ਆਪਦੀ ਰਿਸਪਾਂਸੀਬਿਲਿਟੀ ਹੁੰਦੀ ਹੈ ਅਤੇ ਕੱਪੜੇ ਸਵਾਉਣ ਤੋਂ ਬਾਅਦ ਹੁਣ ਜੇ ਖਰਾਬ ਵੀ ਹੋ ਜਾਣ ਬੇਸ਼ੱਕ ਤਾਂ ਅਸੀਂ ਤੁਹਾਨੂੰ ਵਾਪਸ ਥੋੜ੍ਹੀ ਕਰ ਸਕਦੇ ਹਾਂ ਠੀਕ ਹੈ ਠੀਕ ਹੈ ਜੀ ਕਲਰ ਮੈਂ ਤੁਹਾਨੂੰ ਆ ਕੇ ਦੱਸ ਦੂੰਗੀ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ